ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਡੈਲੀ ਦੀ ਕਰਵਾਈ ਸੀ ਟਿਕਟ ਅਤੇ ਉਹ ਨਾ ਕਿਸੇ ਐਮਰਜੈਂਸੀ ਕਰਕੇ ਨਾ ਸਾਡੀ ਉਹ ਮਤਲਬ ਕੈਂਸਲ ਹੋ ਗਿਆ ਸੀ ਜਾਣਾ ਅਤੇ ਉਸ ਬਾਰੇ ਮੈਂ ਕੁਆਇਰੀ ਲੈਣੀ ਸੀ ਕਿ ਉਹ ਰੀਫੰਡ ਹੋ ਸਕਦੀ ਹੈ ਜੀ ਮੈਂ ਸੱਤ ਨੂੰ ਕਰਵਾਈ ਸੀ ਜੀ ਮੇਰਾ ਸੀ ਏ ਸੀ ਫਾਈਵ ਸਿਕਸ ਅਤੇ ਜੇ ਰੀਫੰਡ ਕਰਵਾਉਂਦੇ ਹਾਂ ਤਾਂ ਕਿੰਨੇ ਦਿਨਾਂ 'ਚ ਮਨੀ ਆ ਜੂਗੀ ਅਤੇ ਮੈਂ ਉਹਨੂੰ ਕਿੰਨੇ ਦਿਨਾਂ ਵਾਸਤੇ ਕਰ ਸਕਦੀ ਹਾਂ ਅੱਛਾ ਜੀ ਅਤੇ ਮਤਲਬ ਡੈਸਟੀਨੇਸ਼ਨ ਉਹੀ ਰਹੇਗੀ ਜਾਂ ਚੇਂਜ ਹੋ ਸਕਦੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਹਾਂ ਦੋ ਤਿੰਨ ਘੰਟੇ 'ਚ ਜਾਂ ਫਿਰ ਕੁਆਰੀ ਕਰਦੀ ਹਾਂ ਠੀਕ ਹੈ ਜੀ